ਹੈਲੋ ਸਤਿ ਸ਼੍ਰੀ ਅਕਾਲ ਜੀ ਸੁਣਾਓ ਕੀ ਹਾਲ ਚਾਲ ਹੈ ਹਾਂਜੀ ਹਾਂਜੀ ਮੈਮ ਦੋਨਾਂ ਦੇ ਕੱਲ੍ਹ ਨੂੰ ਟੈਸਟ ਹੈ ਅਤੇ ਹਾਂਜੀ ਅਤੇ ਛੁੱਟੀ ਕੀ ਕੰਮ ਆ ਤੁਹਾਨੂੰ ਇਹਨਾਂ ਦੀਆਂ ਛੁੱਟੀਆਂ ਅੱਗੇ ਬੜੀਆਂ ਹੋ ਜਾਂਦੀਆਂ ਇੱਕ ਤਾਂ ਬੱਚਾ ਤੁਹਾਡਾ ਪੜ੍ਹਾਈ ਦੇ ਵਿੱਚ ਬਹੁਤ ਨਾਲਾਇਕ ਆ ਹਾਂਜੀ ਅਤੇ ਜੇ ਤੁਸੀਂ ਬਹੁਤਾ ਕਹਿੰਦੇ ਜੇ ਤਾਂ ਫਿਰ ਦੇਖ ਲਓ ਛੁੱਟੀ ਦੇ ਦਿੰਦੇ ਹਾਂ ਪਰ ਛੁੱਟੀ ਅੱਗੇ ਤੋਂ ਨਹੀਂ ਕਰਵਾਇਆ ਕਰੋ ਉਹਨਾਂ ਨੂੰ ਟੈਸਟ ਹੈ ਉਹਨਾਂ ਦੇ ਚਲਣ ਡੇ ਹੁਣ ਅਤੇ ਫਿਰ ਹਾਂਜੀ ਹਾਂਜੀ ਚਲੋ ਠੀਕ ਆ ਜੀ ਓਕੇ ਬਾਏ